ਪੰਜਾਬੀਆਂ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਪੀਣ ਵਾਲੀਆਂ ਜਿਹੜੀਆਂ ਕਿ ਉਹ ਬਹੁਤ ਪਸੰਦ ਕਰਦੇ ਨੇ ਜਿਵੇਂ ਕਿ ਉਹਦੇ ਸਾਰੀ ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਤਾਂ ਚਾਏ ਚਾਹੀਦੀ ਹੁੰਦੀ ਹੈ ਕੋਈ ਚਾਹ ਦਾ ਸ਼ੌਕੀਨ ਕੋਈ ਕੋਫੀ ਦਾ ਅਤੇ ਕੋਈ ਲੱਸੀ ਦਾ ਅਤੇ ਉਸ ਤੋਂ ਬਾਅਦ ਕੋਈ ਨਿੰਬੂ ਪਾਣੀ ਦਾ ਜਿਹੜੇ ਬੱਚੇ ਨੇ ਉਹ ਚੋਕਲੇਟ ਸ਼ੇਕ ਬਨਾਨਾ ਸ਼ੇਕ ਰੂਹ ਅਫਜ਼ਾ 'ਤੇ ਮਰਦੇ ਨੇ ਪਰ ਜਿਹੜੇ ਪੰਜਾਬੀ ਨੇ ਉਹਨਾਂ ਦਾ ਜ਼ਿਆਦਾਤਰ ਪੰਜਾਬੀਆਂ ਦਾ ਜਿਹੜਾ ਦਿਨ ਹੈ ਉਹ ਉਸਦੀ ਸ਼ੁਰੂਆਤ ਚਾਹ ਤੋਂ ਹੁੰਦੀ ਹੈ ਚਾਹ ਲੋਂਗ ਇਲਾਚੀਆਂ ਕੁੱਟ ਕੇ ਦੁੱਧ ਦੇ ਵਿੱਚ ਪਾ ਕੇ ਚਾਹ ਪੱਤੀ ਪਾ ਕੇ ਚੀਨੀ ਪਾ ਕੇ ਕਾੜ ਕਾੜ ਕੇ ਬਣਾਈ ਹੋਈ ਚਾਹ ਪੰਜਾਬੀਆਂ ਨੂੰ ਬਹੁਤ ਹੀ ਪਸੰਦ ਆ ਅਤੇ ਜਿਹੜੇ ਕਿ ਚਾਹ ਦੇ ਸ਼ੌਕੀਨ ਨਹੀਂ ਹਨ ਉਹ ਕੋਫੀ ਦੇ ਚਸਕੇ ਲੈਂਦੇ ਹਨ ਸੁਬਾਹ ਸੁਬਾਹ ਉੱਠ ਕੇ ਜਿਵੇਂ ਕਿ ਦੁੱਧ ਲੈ ਲਿਆ ਦੁੱਧ ਦੇ ਵਿੱਚ ਪਾਈ ਚੀਨੀ ਦੁੱਧ ਦੇ ਵਿੱਚ ਪਾਈ ਕੋਫੀ ਤੁਹਾਡੀ ਗਰਮ ਗਰਮ ਕੋਫੀ ਹੈ ਜਿਹੜੀ ਕਿ ਤਿਆਰ ਹੋ ਜਾਂਦੀ ਹੈ ਅਤੇ ਕਈ ਕੋਲਡ ਕੋਫੀ ਦੇ ਸ਼ੌਕੀਨ ਹੁੰਦੇ ਨੇ ਠੰਡੇ ਦੁੱਧ ਦੇ ਵਿੱਚ ਕੋਫੀ ਅਤੇ ਚੀਨੀ ਮਿਲਾ ਕੇ ਪੀਣਾ ਉਹਨਾਂ ਨੂੰ ਬਹੁਤ ਪਸੰਦ ਹੈ ਬੱਚਿਆਂ ਨੂੰ ਜਿਹੜੀ ਕੋਲਡ ਕੋਫੀ ਹੈ ਉਹ ਬਹੁਤ ਹੀ ਭਾਉਂਦੀ ਆ ਅਤੇ ਚਾਹ ਤੋਂ ਥੋੜ੍ਹੀ ਦੇਰ ਬਾਅਦ ਹੀ ਪੰਜਾਬੀਆਂ ਨੂੰ ਰੋਟੀ ਦੇ ਨਾਲ਼ ਚਾਹੀਦੀ ਹੁੰਦੀ ਹੈ ਲੱਸੀ ਤਾਜ਼ੀ ਤਾਜ਼ੀ ਦਹੀਂ ਨੂੰ ਜਦੋਂ ਰਿੜਕਿਆ ਜਾਂਦਾ ਹੈ ਤਾਂ ਉਸਦਾ ਜਿਹੜਾ ਪਾਣੀ ਹੈ ਉਹ ਅਲੱਗ ਹੋ ਜਾਂਦਾ ਅਤੇ ਜਿਹੜਾ ਮੱਖਣ ਹੈ ਉਹ ਉੱਪਰ ਅਲੱਗ ਤੋਂ ਆ ਜਾਂਦਾ ਮੱਖਣ ਹੈ ਪੰਜਾਬੀ ਰੋਟੀ ਦੇ ਨਾਲ਼ ਖਾਣਾ ਬਹੁਤ ਪਸੰਦ ਕਰਦੇ ਨੇ ਅਤੇ ਨਾਲ਼ ਪੀਣੀ ਪਸੰਦ ਕਰਦੇ ਨੇ ਲੱਸੀ ਅਤੇ ਥੋੜ੍ਹੀ ਦੇਰ ਬਾਅਦ ਜਦੋਂ ਅਗਰ ਉਹ ਕੰਮ ਤੋਂ ਆਉਂਦੇ ਨੇ ਥਕਾਵਟ ਹੁੰਦੀ ਹੈ ਤਾਂ ਉਹਨਾਂ ਨੂੰ ਨਿੰਬੂ ਪਾਣੀ ਹੈ ਸਿਕੰਜਮੀ ਜਿਸ ਨੂੰ ਕਿਹਾ ਜਾਂਦਾ ਉਹ ਪੀਣਾ ਬਹੁਤ ਪਸੰਦ ਹੈ ਪਾਣੀ ਦੇ ਵਿੱਚ ਥੋੜ੍ਹੀ ਜਿਹੀ ਚੀਨੀ ਥੋੜ੍ਹੀ ਜਿਹੀ ਨਿੰਬੂ ਮਿਲਾ ਕੇ ਉਸਨੂੰ ਜਦੋਂ ਮਿਲਾਇਆ ਜਾਂਦਾ ਹੈ ਵਿੱਚ ਕਈ ਪੁਦੀਨਾ ਪਾ ਕੇ ਮਿਲਾਉਂਦੇ ਨੇ ਤਾਂ ਉਸਨੂੰ ਆਪਾਂ ਸਿਕੰਜਵੀ ਜਾ ਨਿੰਬੂ ਪਾਣੀ ਕਹਿੰਦੇ ਹਾਂ ਜੋ ਕਿ ਪੰਜਾਬੀਆਂ ਦੀ ਥਕਾਵਟ ਉਤਾਰਨ ਦੇ ਬਹੁਤ ਜ਼ਿਆਦਾ ਕੰਮ ਆਉਂਦਾ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਬੱਚਿਆਂ ਦੀ ਬੱਚੇ ਜਦੋਂ ਸਕੂਲ ਜਾਂ ਕੋਲਿਜ ਤੋਂ ਮੁੜ ਕੇ ਆਉਂਦੇ ਨੇ ਉਹਨਾਂ ਨੂੰ ਆਪਣੀ ਥਕਾਵਟ ਉਤਾਰਨ ਦੇ ਲਈ ਅਗ ਜੇ ਉਹਨਾਂ ਦੇ ਮੰਮਾ ਉਹਨਾਂ ਦੇ ਲੀਏ ਚੋਕਲੇਟ ਸ਼ੇਕ ਰੂਹ ਅਫਜ਼ਾ ਬਨਾਨਾ ਸ਼ੇਕ ਕੁਝ ਇਹ ਜਿਹਾ ਪਿਲਾ ਦੇਣ ਤਾਂ ਬੱਚਿਆਂ ਦਾ ਜਿਹੜਾ ਥਕਾਵਟ ਹੈ ਥੱਕਿਆ ਹੋਇਆ ਮੂੰਹ ਹੈ ਉਹ ਉਹਨਾਂ ਦੀ ਥਕਾਵਟ ਸਾਰੀ ਉਤਰ ਜਾਂਦੀ ਹੈ ਅਤੇ ਇੱਕ ਬਹੁਤ ਵੱਡੀ ਮੁਸਕਾਨ ਉਹਨਾਂ ਦੇ ਚਿਹਰੇ 'ਤੇ ਆ ਜਾਂਦੀ ਹੈ ਚੋਕਲੇਟ ਸ਼ੇਕ ਹੈ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਫੇਵਰੇਟ ਹੁੰਦਾ ਹੈ ਦੁੱਧ ਦੇ ਵਿੱਚ ਥੋੜ੍ਹੀ ਜਿਹੀ ਚੀਨੀ ਥੋੜ੍ਹੀ ਜਿਹੀ ਚੋਕਲੇਟ ਹੈ ਉਹਨੂੰ ਮਿਲਾ ਕੇ ਉਹਨੂੰ ਮਿਕਸੀ ਦੇ ਵਿੱਚ ਮਿਲਾ ਕੇ ਸਭ ਕੁਝ ਬੱਚਿਆਂ ਨੂੰ ਦੇ ਦਿੱਤਾ ਜਾਵੇ ਤਾਂ ਥੋੜ੍ਹੀ ਜਿਹੀ ਚੋਕਲੇਟ ਚਿਪਸ ਜਾਂ ਕੁਝ ਇਹੋ ਜਿਹਾ ਗਰਨਿਸ਼ ਕਰਕੇ ਬੱਚਿਆਂ ਨੂੰ ਦੇ ਦਿਓ ਤਾਂ ਬੱਚੇ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਂਦੇ ਹਨ ਇਵੇਂ ਹੀ ਕਈ ਜਿਹੜੇ ਕਿ ਚੋਕਲੇਟ ਵਗੈਰਾ ਨਹੀਂ ਪਸੰਦ ਕਰਦੇ ਨੇ ਉਹ ਰੂਹ ਅਫਜ਼ਾ ਵਗੈਰਾ ਉਹਨਾਂ ਦੇ ਜਿਹੜੇ ਮਾਤਾ ਨੇ ਉਹਨਾਂ ਨੂੰ ਬਣਾ ਕੇ ਦਿੰਦੇ ਨੇ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਰੂਹ ਅਫਜ਼ਾ ਘੋਲੋ ਅਤੇ ਥੋੜ੍ਹੀ ਬਹੁਤ ਚੀਨੀ ਅਤੇ ਨਾਲ ਠੰਡੀ ਠੰਡੀ ਬਰਫ ਪਾ ਦਿਓ ਬੱਚੇ ਦੀ ਜਿਹੜੀ ਥਕਾਵਟ ਹੈ ਉਹ ਦੂਰ ਹੋ ਜਾਂਦੀ ਹੈ ਬੱਚੇ ਹੀ ਨਹੀਂ ਬੜੇ ਵੀ ਇਸਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅਤੇ ਗੱਲ ਅੱਗੇ ਆ ਗਈ ਗੱਲ ਬਨਾਨਾ ਸ਼ੇਕ ਦੀ ਯਾ ਮੈਂਗੋ ਸ਼ੇਕ ਦੀ ਬੱਚਿਆਂ ਨੂੰ ਇਹੋ ਜਿਹੇ ਜਿਹੜੇ ਫਰੂਟਸ ਵਾਲੇ ਸ਼ੇਕ ਨੇ ਉਹ ਵੀ ਬਹੁਤ ਸਾਰੇ ਪਸੰਦ ਆਉਂਦੇ ਨੇ ਕੋਈ ਫੈਲੂਦਾ ਕੋਈ ਬਨਾਨਾ ਸ਼ੇਕ ਕੋਈ ਮੈਂਗੋ ਸ਼ੇਕ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਫਰੂਟਸ ਵੀ ਜਿਹਦੇ ਵਿੱਚ ਹੁਣ ਤਾਂ ਉਹ ਗੁਣਕਾਰੀ ਵੀ ਬਣ ਜਾਂਦੀਆਂ ਨੇ ਅਤੇ ਬੱਚਿਆਂ ਦੀ ਸਿਹਤ ਦੇ ਲੀਏ ਵੀ ਬਹੁਤ ਵਧੀਆ ਹੁੰਦੀਆਂ ਨੇ ਬਾਹਰ ਦੇ ਬਾਹਰ ਦੀਆਂ ਹੋਰ ਚੀਜ਼ਾਂ ਦੇ ਨਾਲੋਂ ਇਹ ਸਭ ਜਿਹੜੇ ਪੰਜਾਬੀਆਂ ਏ ਇਹਨਾਂ ਦੀ ਨੋਰਮਲ ਜਿਹੜੀ ਲਾਈਫ ਹੈ ਉਸ ਦਾ ਇੱਕ ਹਿੱਸਾ ਹੈ ਅਤੇ ਰਾਤ ਨੂੰ ਸੌਣ ਦੇ ਵੇਲੇ ਜਦੋਂ ਪੰਜਾਬੀ ਇਕਦਮ ਥੱਕ ਚੁੱਕੇ ਹੁੰਦੇ ਨੇ ਰੋਟੀ ਖਾਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਗਰਮ ਗਰਮ ਜਿਹੜਾ ਦੁੱਧ ਹੈ ਉਹ ਵੀ ਚਾਹੀਦਾ ਹੁੰਦਾ ਹੈ ਜਿਸ ਦੇ ਨਾਲ਼ ਉਹਨਾਂ ਨੂੰ ਮਿੱਠੀ ਮਿੱਠੀ ਜਿਹੜੀ ਨੀਂਦ ਹੈ ਉਹ ਆ ਸਕੇ